ਹੈਲੋ ਹਾਂ ਹਾਂਜੀ ਮੈਂ ਅਨੂ ਸ਼ਰਮਾ ਬੋਲ ਰਹੀ ਹਾਂ

ਮੈਮ ਮੈਂ ਕੀਤੀ ਸੀਗੀ ਮੈਂ ਮੇਰਾ ਬੇਟਾ ਇੱਥੇ ਹੈ ਸ਼ਿਵਾਲਿਕ ਸਕੂਲ ਮੈਂ ਸ਼ਿਵਾਲਿਕ ਸਕੂਲ ਫ਼ੋਨ ਕੀਤਾ ਹੋਇਆ ਹਾਂਜੀ ਐਕਚੁਲੀ ਮੈਂ ਉਹਦੀ ਰਿਗਾਰਡਿੰਗ ਫ਼ੋਨ ਕੀਤਾ ਸੀਗਾ ਕਿਉਂਕਿ ਅੱਜ ਮੈਨੂੰ ਥੋੜ੍ਹਾ ਸਾ ਥੋੜ੍ਹਾ ਜਿਹਾ ਕਰ ਪਰਸਨਲ ਕੰਮ ਸੀਗਾ ਜਿਹਦੇ ਕਰਕੇ ਮੈਂ ਅੱਜ ਪੇਰੈਂਟਸ ਮੀਟਿੰਗ ਅਟੈਂਡ ਨਹੀਂ ਕਰ ਪਾਈ ਤਾਂ ਮੈਂ ਉਹਦੀ ਫੀਡਬੈਕ ਲੈਣੀ ਸੀਗੀ ਕ੍ਰਿਸ਼ਨਾ ਸ਼ਰਮਾ ਕਲਾਸ ਥਰਡ

ਓਕੇ ਓਕੇ ਮੈਮ ਬਟ ਓਹ ਫਸਟ ਟਾਇਮ ਹੋਇਆ ਹੈ ਕਿ ਮੈਂ ਮੀਟਿੰਗ ਅਟੈਂਡ ਨਹੀਂ ਕਰ ਪਾਈ ਉੱਦਾਂ ਤਾਂ ਮੈਂ ਰੈਗੂਲਰ ਕਰਦੀ ਹਾਂ ਬਟ ਥੋੜ੍ਹਾ ਜਾ ਪਰਸਨਲ ਪ੍ਰੋਬਲਮ ਆ ਗਈ ਸੀ ਉਹਦੇ ਕਰਕੇ ਮੇਰੇ ਕੋਲ ਆ ਨਹੀਂ ਹੋਇਆ ਹਾਂਜੀ ਮੈਮ ਓਕੇ ਓਕੇ ਓਕੇ ਓਕੇ ਓਕੇ ਠੀਕ ਹੈ ਮੈਮ ਓਕੇ ਜੀ ਮੈਮ ਠੀਕ ਹੈ ਮੈਮ

ਹਾਂਜੀ ਮੈਮ ਮੈਮ ਓਹ ਕਰਦਾ ਤਾਂ ਹੈਗਾ ਆ ਬਟ ਮੈਂ ਵੀ ਕੋਸ਼ਿਸ਼ ਕਰਵਾਨੀ ਹਾਂ ਕਿਉਂਕਿ ਮੈਂ ਜੋਬ ਸਰਕਲ ਦੇ ਵਿੱਚ ਆ ਤਾਂ ਮੈਂ ਜਿੰਨਾਂ ਟਾਇਮ ਦੇ ਹੁੰਦਾ ਮੈਂ ਉਹਨਾਂ ਦੇ ਵੀ ਦੇਂਦੀ ਵੀ ਹੈਗੀ ਆ ਬਟ ਫਿਰ ਵੀ ਤੁਸੀਂ ਮੇਰੀ ਰਿਕੁੈਸਟ ਹੈ ਕਿ ਮ ਤੁਸੀਂ ਵੀ ਮਾੜਾ ਜਿਹਾ ਥੋੜ੍ਹਾ ਜਿਹਾ ਇਹਦੇ ਵੱਲ ਧਿਆਨ ਦੇਵੋ ਕਿਉਂ ਮੈਨੂੰ ਲਾਸਟ ਟਾਇਮ ਦੇ ਵਿੱਚ ਇਹਦੀ ਸ਼ਿਕਾਇਤਾਂ ਕਾਫੀ ਮਿਲੀਆਂ ਸੀ ਉਹਦੇ ਰਿਗਾਰਡਿੰਗ ਮੈਂ ਪੁੱਛਣਾ ਆ ਓਕੇ ਮੈਮ ਠੀਕ ਹੈ ਮੈਮ

ਓਕੇ ਮੈਮ ਠੀਕ ਹੈ ਮੈਮ ਥੈਂਕ ਯੂ ਸੋ ਮਚ ਮੈਮ ਓਕੇ ਮੈਮ ਓਕੇ ਮੈਮ